ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦੇ ਸਾਹਮਣੇ ਸਾਨੂੰ ਕਈ ਹੀ ਚਿੱਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹਨ ਜਿਹੜੇ ਕਿ ਸਾਰੇ ਮਾਂ ਪਿਓ ਨਹੀਂ ਭਰ ਸਕਦੇ ਕੁਝ ਮਾਂ ਪਿਓ ਅਜਿਹੇ ਹੁੰਦੇ ਹਨ ਜਿਹੜੀਆਂ ਆਪਣੀਆਂ ਆਮਦਨ ਦੀਆਂ ਕਮੀਆਂ ਕਾਰਨ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਇਸ ਕਰਕੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਪਾਉਣਾ ਪੈਂਦਾ ਹੈ ਕਿਉਂਕਿ ਸਕੂਲਾਂ ਵਿੱਚ ਬੱਚੇ ਬਹੁਤ ਜ਼ਿਆਦਾ ਹਨ ਅਤੇ ਉਹਨਾਂ ਨੂੰ ਪੜ੍ਹਾਉਣ ਲਈ ਟੀਚਰ ਬਹੁਤ ਘੱਟ ਹਨ ਜਿਵੇਂ ਕਿ ਇੱਕ ਕਲਾਸ ਦੇ ਛੇ ਛੇ ਸੈਕਸ਼ਨ ਹੁੰਦੇ ਹਨ ਹਰੇਕ ਸੈਕਸ਼ਨ ਵਿੱਚ ਸੱਤਰ ਬੱਚੇ ਹੁੰਦੇ ਹਨ ਅਤੇ ਸੱਤਰ ਬੱਚੇ ਲਈ ਕਮਰੇ ਬਹੁਤ ਥੋੜੇ ਹੁੰਦੇ ਹਨ ਸਾਨੂੰ ਚਾਹੀਦਾ ਹੈ ਕਿ ਜੇਕਰ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਸਾਨੂੰ ਕਮਰਿਆਂ ਦੇ ਵੀ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂ ਜੋ ਅਸੀਂ ਬੱਚਿਆਂ ਨੂੰ ਬੜੀ ਆਸਾਨੀ ਦੇ ਨਾਲ ਅਤੇ ਬੜੀਆਂ ਵਧੀਆ ਸੁਵਿਧ ਸੁਵਿਧਾ ਨਾਲ ਉਹਨਾਂ ਨੂੰ ਪੜ੍ਹਾ ਸਕੀਏ ਅਤੇ ਬੱਚੇ ਜ਼ਿਆਦਾ ਹੋਣ ਨਾਲ ਸਾਨੂੰ ਇੱਕ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਟੀਚਰ ਘੱਟ ਹੋਣਗੇ ਤਾਂ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਇਸ ਕਰਕੇ ਸਾਨੂੰ ਟੀਚਰ ਵੀ ਵੱਧ ਤੋਂ ਵੱਧ ਰੱਖਣੇ ਚਾਹੀਦੇ ਹਨ ਤਾਂ ਜੋ ਸਾਡਾ ਸਟਾਫ ਜ਼ਿਆਦਾ ਹੋਵੇਗਾ ਤਾਂ ਬੱਚਿਆਂ ਨੂੰ ਵੀ ਚੰਗੀ ਪੜ੍ਹਾਈ ਦੇ ਸਕਦਾ ਹੈ ਅਤੇ ਸਾਡੇ ਬੱਚੇ ਵੀ ਮਨ ਲਾ ਕੇ ਪੜ੍ਹ ਸਕਦੇ ਹਨ ਕਿਉਂਕਿ ਜੇਕਰ ਟੀਚਰ ਨਾ ਹੋਵੇ ਤਾਂ ਬੱਚੇ ਵੀ ਪੜ੍ਹਾਈ ਤੋਂ ਦਿਲ ਚੁਰਾਉਂਦੇ ਹਨ ਇਸ ਕਰਕੇ ਸਾਡੇ ਸਮਾਜ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ ਕਿ ਸਾਨੂੰ ਸਿੱਖਿਆ ਪ੍ਰਣਾਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਵਿੱਚ ਕਈ ਸੁਧਾਰ ਵੀ ਕਰਨੇ ਚਾਹੀਦੇ ਹਨ ਤਾਂ ਜੋ ਸਿੱਖਿਆ ਦਾ ਪ੍ਰਸਾਰ ਹੋ ਸਕੇ